ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੇ ਵੱਡੇ ਅਤੇ ਛੋਟੇ ਉਦਯੋਗ ਅਤੇ ਕਾਰੋਬਾਰ ਵਿਕਸਿਤ ਹੋਏ ਹਨ ਜਿਨ੍ਹਾਂ ਦੇ ਵਿੱਚ ਉਦਯੋਗਿਕ ਖੇਤਰ ਵਿੱਚ ਫੈਕਟਰੀਆਂ ਸ਼ਾਮਿਲ ਹਨ ਅਤੇ ਖਰੀਦਦਾਰੀ ਲਈ ਸ਼ਾਪਿੰਗ ਮਾਲ ਵਿਕਸਿਤ ਹੋਏ ਹਨ ਮਨੋਰੰਜਨ ਦੇ ਲਈ ਸਿਨੇਮਾ ਘਰ ਪਾਰਕਾਂ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਖਾਣ ਪੀਣ ਲਈ ਢਾਬੇ ਰੈਸਟੋਰੈਂਟ ਵਿਕਸਿਤ ਹੋਏ ਹਨ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਆਰਥਿਕਤਾ ਨੂੰ ਬਹੁਤ ਮਜਬੂਤ ਬਣਾਉਂਦੇ ਅਤੇ ਵਿਕਸਿਤ ਕਰ ਰਹੇ ਹਨ ਇਹਨਾਂ ਸਾਰੀਆਂ ਉਦਯੋਗਿਕ ਅਤੇ ਕਾਰੋਬਾਰੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਬਹੁਤ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸੇ ਵੀ ਏਰੀਆ ਅਤੇ ਕਾਰੋਬਾਰ ਉਦਯੋਗ ਵਿਕਸਿਤ ਕਰਨ ਲਈ ਆਲੇ ਦੁਆਲੇ ਦੇ ਲੋਕਾਂ ਆਵਾਜਾਈ ਪ੍ਰਸ਼ਾਸਨ ਦੀਆਂ ਸ਼ਰਤਾਂ ਨੂੰ ਪੂਰਾ ਬੜੀ ਮੁਸ਼ਕਿਲ ਨਾਲ਼ ਕੀਤਾ ਜਾਂਦਾ ਹੈ